ਸਤਿ ਸ਼੍ਰੀ ਅਕਾਲ ਜੀ ਗਾਇਕੀ ਮੁੱਢ ਤੋਂ ਹੀ ਮਨੁੱਖੀ ਮਨ ਅਤੇ ਕੋਮਲ ਭਾਸ਼ਾ ਦਾ ਪ੍ਰਤੀਕ ਹੈ ਪੰਜਾਬ ਵਿੱਚ ਗਾਇਕੀ ਨੂੰ ਬਹੁਤ ਹੀ ਮਹੱਤਤਾ ਦਿੱਤੀ ਜਾਂਦੀ ਹੈ ਗਾਇਕੀ ਦੀ ਸੰਗਤ ਵਿੱਚ ਸੰਗੀਤ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਗਾਇਕੀ ਨੂੰ ਬਹੁਤ ਹੀ ਉੱਚਾ ਦਰਜਾ ਦਿੱਤਾ ਗਿਆ ਹੈ ਇਸ ਕਰਕੇ ਮੈਨੂੰ ਗਾਇਕੀ ਦਾ ਬਹੁਤ ਹੀ ਸ਼ੌਂਕ ਹੈ ਸਾਡੇ ਸਕੂਲ ਵਿੱਚ ਹੀ ਇੱਕ ਅਲੱਗ ਤੋਂ ਹੀ ਮਿਊਜਿਕ ਦਾ ਵਿਸ਼ਾ ਦਿੱਤਾ ਗਿਆ ਹੈ ਮੈਨੂੰ ਗਾਇਕ ਮੈਨੂੰ ਉਸ ਵਿੱਚ ਹਿੱਸਾ ਲੈਣਾ ਬਹੁਤ ਹੀ ਪਸੰਦ ਹੈ ਅਤੇ ਸਾਡੇ ਸਕੂਲ ਵਿੱਚ ਹੋ ਰਹੇ ਕੋਈ ਵੀ ਪ੍ਰੋਗਰਾਮ ਵਿੱਚ ਮੈਂ ਸਾਰਿਆਂ ਤੋਂ ਪਹਿਲਾਂ ਹਿੱਸਾ ਲੈਂਦੀ ਹਾਂ ਅਤੇ ਉਸ ਵਿੱਚ ਮੈਂ ਪਹਿਲੇ ਨੰਬਰ 'ਤੇ ਆਉਂਦੀ ਹਾਂ ਅਤੇ ਹੌਲੀ ਹੌਲੀ ਮੈਨੂੰ ਮਿਊਜ਼ਿਕ ਦਾ ਵੀ ਬਹੁਤ ਹੀ ਸ਼ੌਂਕ ਹੋ ਗਿਆ ਹੈ ਇਸ ਲਈ ਮੈਂ ਗੈ ਗੈ ਗਾਇਕ ਇਸ ਵਿੱਚ ਇਸ ਲਈ ਮੈਂ ਸ਼ੁਰੂ ਤੋਂ ਹੀ ਮੈਨੂੰ ਗਾਉਣ ਦਾ ਬਹੁਤ ਹੀ ਸ਼ੌਂਕ ਹੈ ਇਸ ਲਈ ਸਾਡੇ ਸਮਾਜ ਵਿੱਚ ਗਾਇਕੀ ਨੂੰ ਬਹੁਤ ਹੀ ਮਹੱਤਤਾ ਦਿੱਤੀ ਗੀ ਗਈ ਹੈ ਮੈਨੂੰ ਹਰ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਪਸੰਦ ਹੈ ਅੱਜ ਹੀ ਮੈਨੂੰ ਗਾਇਕੀ ਦਾ ਬਹੁਤ ਹੀ ਸ਼ੌਂਕ ਹੋ ਗਿਆ ਹੈ ਗਾਇਕੀ ਮੁੜ ਤੋਂ ਹੀ ਮਨੁੱਖੀ ਮਨ ਅਤੇ ਕੋਮਲ ਭਾਸ਼ਾ ਦਾ ਪ੍ਰਤੀਕ ਹੈ